ਆਪਣੇ ਘਰ ਦੇ ਵਿੱਚ ਖਾਣਾ ਮੈਂ ਖੁਦ ਆਪ ਬਣਾਉਂਦੀ ਹਾਂ ਕੁਝ ਸਿਹਤਮ ਸਿਹਤਮੰਦ ਪਕਵਾਨ ਜਿਵੇਂ ਖਿਚੜੀ ਹੋ ਗਈ ਦਾਲਾਂ ਨਾਲ ਬਣਾਈ ਗਈ ਕੋਈ ਸਬਜ਼ੀ ਹੋ ਗਈ ਹਰੀਆਂ ਸਬਜ਼ੀਆਂ ਆਦਿ ਇਹ ਅਸੀਂ ਸਭ ਕੁਛ ਸਿਹਤਮੰਦ ਹੁੰਦੇ ਹਨ ਜੋ ਕਿ ਆਪਣੇ ਪਰਿਵਾਰ ਦੇ ਲਈ ਬਹੁਤ ਹੀ ਵਧੀਆ ਅਤੇ ਸਰੀਰ ਲਈ ਬਹੁਤ ਹੀ ਸਿਹਤਮੰਦ ਹੁੰਦੇ ਹਨ ਦਾਲਾਂ ਚਾਵਲ ਬਾਜਰੇ ਦੀ ਰੋਟੀ ਆਦਿ ਵਗੈਰਾ ਇਹ ਸਭ ਸਾਨੂੰ ਸ਼ਕਤੀ ਦਿੰਦੀਆਂ ਹਨ ਬੌਡੀ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਬਾਹਰਲਾ ਖਾਣਾ ਜੋ ਹੁੰਦਾ ਹੈ ਉਹ ਆਪਣੇ ਸਿਹਤ ਲਈ ਵਧੀਆ ਨਹੀਂ ਹੁੰਦਾ ਅਤੇ ਉਹਨਾਂ ਵਿੱਚ ਬਹੁਤ ਹੀ ਬੇਕਾਰ ਮਸਾਲੇ ਜਾਂ ਕੁਛ ਔਰ ਲੱਗੇ ਹੁੰਦੇ ਹਨ ਜੋ ਸਰੀਰ ਲਈ ਵਧੀਆ ਨਹੀਂ ਹੁੰਦੇ ਸਾ ਅਤੇ ਘਰ ਖਾਣਾ ਜਦੋਂ ਵੀ ਮੈਂ ਬਣਾਉਂਦੀ ਹਾਂ ਤਾਂ ਵਧੀਆ ਤਰੀਕੇ ਅਤੇ ਢੰਗ ਨਾਲ ਬਣਾਉਂਦੀ ਹਾਂ ਜੋ ਕਿ ਸ ਬਹੁਤ ਹੀ ਸ਼ੁੱਧ ਅਤੇ ਸਾਫ਼ ਹੁੰਦਾ ਹੈ ਅਤੇ ਜਿੰਨਾ ਵੀ ਖਾਣਾ ਹੁੰਦਾ ਹੈ ਬਹੁਤ ਹੀ ਵਧੀਆ ਹੁੰਦਾ ਹੈ ਜੋ ਮੇਰੇ ਪਰਿਵਾਰ ਨੂੰ ਵੀ ਬਹੁਤ ਹੀ ਪਸੰਦ ਆਉਂਦਾ ਉਹ ਵੀ ਇਸ ਨੂੰ ਬੜੇ ਵਧੀਆ ਅਤੇ ਖੁਸ਼ੀ ਨਾਲ ਖਾਂਦੇ ਹਨ ਅਤੇ ਇਹ ਸ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਚਾਵਲ ਦਾਲਾਂ ਜੋ ਵੀ ਹਨ ਇਹ ਸਭ ਸਾਨੂੰ ਸਿਹਤਮੰਦ ਰੱਖਦੀਆਂ ਹਨ ਅਤੇ ਇਸ ਖਾਣ ਵਿੱਚ ਵੀ ਬਹੁਤ ਸਵਾਦਿਸ਼ਟ ਹੁੰਦੀਆਂ ਹਨ